ਖਬਰਾਂ ਵਿ ਖਬਰਾਂ ਵਿੱਚ ਦਿਖਾਈਆਂ ਜਾਣ ਵਾਲੀਆਂ ਚੀਜ਼ਾਂ ਅਤੇ ਹਕੀਕਤ ਵਿੱਚ ਬਹੁਤ ਅੰਤਰ ਹੈ ਖਬਰਾਂ ਵਿੱਚ ਦਿਖਾਇਆ ਜਾਂਦਾ ਹੈ ਕਿ ਪੁਲਿਸ ਵਾਲਿਆਂ ਨੇ ਇੰਨੇ ਲੋਕਾਂ ਨੂੰ ਨਸ਼ਿਆਂ ਨੂੰ ਗ੍ਰਿਫਤਾਰ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਸਲ ਵਿੱਚ ਇਹੋ ਜਿਹਾ ਕੁਝ ਹੋਇਆ ਨਹੀਂ ਹੁੰਦਾ ਉਹਨਾਂ ਨੇ ਬਹੁਤ ਹੀ ਘੱਟ ਨਸ਼ੇ ਨੂੰ ਫੜਿਆ ਹੁੰਦਾ ਹੈ ਅਤੇ ਕੁਝ ਲੋਕਾਂ ਨੂੰ ਵੈਸੇ ਹੀ ਫੜ ਲਿੱਤਾ ਜਾਂਦਾ ਹੈ ਜਾਣੇ ਅਣਜਾਣੇ ਵਿੱਚ ਪਰ ਉਹ ਦਿਖਾਉਂਦੇ ਹਨ ਕਿ ਇਹ ਬਹੁਤ ਵੱਡੇ ਨਸ਼ੇੜੀ ਹਨ ਅਤੇ ਸਮਗਲਰ ਹਨ ਜੋ ਕਿ ਨਸ਼ੇ ਨੂੰ ਅੱਗੇ ਟ੍ਰਾਂਸਫਰ ਕਰਦੇ ਹਨ ਅਸੀਂ ਖਬਰਾਂ ਵਿੱਚ ਵੇਖਦੇ ਹਾਂ ਕਿ ਬਹੁਤ ਸਾਰੇ ਐਕਸੀਡੈਂਟ ਹੋ ਰਹੇ ਹਨ ਅਸਲ ਵਿੱਚ ਇਹੋ ਜਿਹਾ ਕੁਝ ਹੋ ਹੀ ਨਹੀਂ ਰਿਹਾ ਹੁੰਦਾ ਅਸਲ ਵਿੱਚ ਇਹੋ ਜਿਹਾ ਕੁਝ ਹੁੰਦਾ ਹੀ ਨਹੀਂ ਇਹ ਸਭ ਕੁਝ ਝੂਠ ਹੈ ਹਕੀਕਤ ਇਸ ਤੋਂ ਬਿਲਕੁਲ ਹੀ ਅਲੱਗ ਹੈ ਹਾਲੀ ਕਿ ਹਾਲੀ ਵਿੱਚ ਹੀ ਹਲੇ ਕੇਦਾਰਨਾਥ ਵਿੱਚ ਦੱਸਿਆ ਜਾ ਰਿਹਾ ਸੀਗਾ ਕਿ ਬਰਫ ਡਿੱਗ ਰਹੀ ਹੈ ਉਹ ਤਾਂ ਗੱਲ ਸੱਚੀ ਹੈ ਕਿ ਬਰਫ ਡਿੱਗ ਰਹੀ ਆ ਉੱਥੇ ਦੱਸਿਆ ਗਿਆ ਪਹਾੜ ਡਿੱਗ ਗਿਆ ਅਤੇ ਬਾੜ ਆ ਗਈ ਅਜਿਹਾ ਕੁਛ ਨਹੀਂ ਸੀਗਾ ਉੱਥੇ ਬਿਲਕੁਲ ਹੀ ਪਹਾੜ ਨਹੀਂ ਡਿੱਗੇ ਨਾ ਹੀ ਬਾੜ ਆਈ ਖਬਰਾਂ ਬਹੁਤ ਹੀ ਅਲੱਗ ਹਨ ਖਬਰਾਂ ਵਿੱਚ ਜੋ ਦਿਖਾਇਆ ਜਾਂਦਾ ਹੈ ਹਕੀਕਤ ਵਿੱਚ ਅਜਿਹਾ ਬਿਲਕੁਲ ਨਹੀਂ ਹੁੰਦਾ ਹਕੀਕਤ ਹੋਰ ਹੀ ਹੁੰਦੀ ਹੈ ਆਪਾਂ ਮੰਨ ਲੈਂਦੇ ਅੱਗੇ ਫਿਲਮਾਂ ਫਿਲਮਾਂ ਵੀ ਦਿਖਾਇਆ ਜਾਂਦਾ ਹੈ ਕਿੰਨੀ ਲੜਾਈ ਮਾਰ ਹੋਈ ਹੈ ਕਿੰਨੀ ਟੁੱਟ ਭੱਜ ਹੋਈ ਆ ਅਜਿਹਾ ਕੁਝ ਹੋਇਆ ਹੀ ਨਹੀਂ ਹੁੰਦਾ ਬਿਲਕੁਲ ਉਸ ਤੋਂ ਹਕੀਕਤ ਡਿਫਰੈਂਟ ਹੁੰਦੀ ਹੈ ਖਬਰਾਂ ਤੇ ਹਕੀਕਤ ਬਹੁਤ ਹੈ ਖਬਰਾਂ ਵਿੱਚ ਦਿਖਾਇਆ ਜਾਂਦਾ ਹੈ ਕਿਸੇ ਦਾ ਐਕਸੀਡੈਂਟ ਹੋ ਗਿਆ ਲੋਕ ਇਸ ਤੋਂ ਬਹੁਤ ਪ੍ਰਭਾਵਿਤ ਹੁੰਦਾ ਸਮਾਜ ਇਸ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ ਲੋਕ ਅਫਸੋਸ ਕਰਦੇ ਹਨ ਕਿ ਕਿਸੇ ਦਾ ਮਾਂ ਕਿਸੇ ਦੀ ਪੁੱਤ ਕਿਸੇ ਦਾ ਪਰਿਵਾਰ ਐਕਸੀਡੈਂਟ 'ਚ ਮਾਰਿਆ ਗਿਆ ਲੋਕ ਬਹੁਤ ਅਫਸੋਸ ਕਰਦੇ ਹਨ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਲੋਕ ਖਬਰਾਂ ਨਾਲ ਬਹੁਤ ਹੀ ਸਮਾਜ 'ਤੇ ਭੈੜਾ ਪ੍ਰਭਾਵ ਪੈਂਦਾ ਹੈ ਖਬਰਾਂ ਨਾਲ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਹੈ ਖਬਰਾਂ ਨਾਲ ਬਹੁਤ ਹੀ ਜਾਣਕਾਰੀਆਂ ਸਾਨੂੰ ਮਿਲਦੀਆਂ ਹਨ ਪਰ ਉਹਨਾਂ ਵਿੱਚੋਂ ਕੁਝ ਹਕੀਕਤ ਨਹੀਂ ਹੁੰਦੀਆਂ ਕੁਝ ਸੱਚਾਈ ਹੁੰਦੀ ਹੈ ਕਿਸੇ ਵਿੱਚ ਅਤੇ ਕਿਸੇ ਵਿੱਚ ਬਹੁਤ ਹੀ ਜ਼ਿਆਦਾ ਰੱਜ ਕੇ ਝੂਠ ਬੋਲਿਆ ਜਾਂਦਾ ਹੈ